ਦਵਾਈਆਂ ਕਫਾਇਤੀ ਵੀ ਹਨ ਅਤੇ ਮਹਿੰਗੀਆਂ ਵੀ ਬਹੁਤ ਆ ਪਰ ਕਦੇ ਇਹ ਅਸੀਂ ਨਹੀਂ ਕਿਹਾ ਜਾ ਸਕਦਾ ਕਿ ਅਸੀਂ ਕਿੰਨਾ ਹਿਸਾਬ ਦੀ ਆਮਦਨ ਦਾ ਕਿੰਨਾ ਹਿੱਸਾ ਦਵਾਈਆਂ 'ਤੇ ਖਰਚਦੇ ਹਨ ਪਰਮਾਤਮਾ ਕਰੇ ਬਿਮਾਰੀ ਨਾ ਹੋਵੇ ਤਾਂ ਦਵਾਈਆਂ 'ਤੇ ਕੋਈ ਵੀ ਖਰਚਾ ਨਹੀਂ ਹੁੰਦਾ ਅਗਰ ਬਿਮਾਰੀ ਆ ਜਾਵੇ ਤਾਂ ਹਿੱਸੇ ਨਹੀਂ ਦੇਖੇ ਜਾਂਦੇ ਫਿਰ ਬੇਤਹਾ ਖਰਚਾ ਹੋ ਸਕਦਾ ਹੈ ਪਰ ਅੱਜ ਕੱਲ੍ਹ ਹੋਸਪਿਟਲਾਂ ਹਸਪਤਾਲਾਂ ਵਿੱਚ ਆਮ ਦਵਾਈਆਂ ਸਾਨੂੰ ਫਰੀ ਵਿੱਚ ਮੁਹ ਮੁਹੱਈਆ ਕਰਵਾਈਆਂ ਜਾਂਦੀਆਂ ਹਨ ਜਿਸ ਨਾਲ ਕਾਫੀ ਜ਼ਿਆਦਾ ਖਰਚਾ ਬੱਚ ਸਕਦਾ ਹੈ ਕਈ ਇਹੋ ਜਿਹੀਆਂ ਸਕੀਮਾਂ ਹਨ ਜਿਹਨਾਂ ਵੀ ਨਾਲ ਅਸੀਂ ਸਰਕਾਰੀ ਹਸਪਤਾਲਾਂ ਤੋਂ ਇਲਾਜ ਫਰੀ ਕਰਵਾ ਸਕਦੇ ਹਾਂ ਅਤੇ ਇਲਾਜ ਦੇ ਨਾਲ ਨਾਲ ਦਵਾਈਆਂ ਵੀ ਲੈ ਸਕਦੇ ਹਾਂ ਅਤੇ ਦਵਾਈਆਂ ਮੁਫਤ ਵਿੱਚ ਉਪਲਬਧ ਹੁੰਦੀਆਂ ਹਨ